ਸਾਡੇ ਭਾਰਤ ਰਾਜ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ ਇਹ ਹਨ ਕਿ ਇੱਥੋਂ ਦਾ ਸੱਭਿਆਚਾਰ ਪਹਿਰਾਵਾ ਰਸਮ ਰਿਵਾਜ ਰੀਤੀ ਰਸਮ ਰਿਵਾਜ ਆਦਿ ਸਭ ਕੁਝ ਹੋਰ ਰਾਜਾਂ ਨਾਲੋਂ ਵੱਖਰਾ ਹੈ ਇੱਥੋਂ ਸਾਡੇ ਭਾਰਤ ਰਾਜ ਦੇ ਧਰਮ ਵੀ ਅਲੱਗ ਹਨ ਉਹ ਹੋਰਾਂ ਰਾਜਾਂ ਨਾਲੋਂ ਜਿਵੇਂ ਕਿ ਸਾਡੇ ਭਾਰਤ ਰਾਜ ਦੇ ਧਰਮ ਸਿੱਖ ਹਿੰਦੂ ਮੁਸਲਮਾਨ ਈਸਾਈ ਆਦਿ ਹਨ ਇਹ ਹੋਰ ਰਾਜਾਂ ਨਾਲੋਂ ਸਾਡੇ ਹੀ ਰਾਜ ਵਿੱਚ ਇਹ ਧਰਮ ਹਨ